ਹਾਂਜੀ ਸਰ ਇੱਕ ਕੋਸ਼ਨ ਸੀ ਡਾਕਯੂਮੈਂਟ ਕਿਹੜੇ ਕਿਹੜੇ ਚਾਹੀਦੇ ਹੈ ਸਾਰੇ ਅਗਰ ਤੁਸੀਂ ਲਿਸਟ ਕਰ ਦਵੋਗੇ ਤਾਂ ਪਾਸਪੋਰਟ ਲਈ ਠੀਕ ਹੈ ਹਾਂਜੀ ਹਾਂਜੀ ਸਰ ਫਸਟ ਟਾਈਮ ਅਪਲਾਈ ਕਰ ਰਿਹਾ ਨਹੀਂ ਕਦੇ ਨਹੀਂ ਕੀਤਾ ਕਿਸੇ ਨੇ ਵੀ ਨਹੀਂ ਕੀਤਾ ਠੀਕ ਹੈ ਆਧਾਰ ਕਾਰਡ ਦੀ ਸਰ ਫੋਟੋਕੋਪੀ ਚੱਲੇਗੀ ਕਿ ਓਰੀਜਨਲ ਉੱਥੇ ਲੈ ਕੇ ਜਾਣਾ ਪਵੇਗਾ ਠੀਕ ਹੈ ਅਤੇ ਅਟੈਸਟ ਕਰਨੇ ਪੈਣਗੇ ਠੀਕ ਹੈ ਸਰ ਤੁਸੀਂ ਦੱਸੋਂਗੇ ਵਾਪਸ ਤੋਂ ਇੱਕ ਵਾਰੀ ਕਿੰਨੀਆਂ ਫੋਟੋਆਂ ਅਤੇ ਕਿਸਦੀਆਂ ਕਿਸਦੀਆਂ ਫੋਟੋਆਂ ਫੈਮੀਲੀ 'ਚ ਚਾਹੀਦੀਆਂ ਹੋਣਗੀਆਂ ਠੀਕ ਹੈ ਅਤੇ ਨੋਡਲ ਔਫਿਸਰ ਤੋਂ ਅਟੈਸਟ ਕਰਾਉਣਾ ਪਵੇਗਾ ਸਾਰਾ ਕੁਛ ਠੀਕ ਹੈ ਅਤੇ ਸਰ ਅਗਰ ਡੇਟ ਆਫ ਬਰਥ ਸਰਟੀਫਿਕੇਟ 'ਤੇ ਪਿਤਾ ਜੀ ਦਾ ਜਾਂ ਮਾਤਾ ਜੀ ਦਾ ਨਾਮ 'ਚ ਥੋੜ੍ਹੀ ਫ਼ਰਕ ਹੈ ਅਤੇ ਟੈਂਥ ਦੇ ਸਰਟੀਫਿਕੇਟ ਨਾਲੋਂ ਤਾਂ ਨਾਲ ਕੀ ਲਗਾਉਣਾ ਪਵੇਗਾ ਐਕਸਟਰਾ ਹਾਂਜੀ ਅਤੇ ਐਮ ਐਲ ਏ ਦੇ ਜਾਂ ਨੋਟਰੀ ਸਾਈਂਡ ਕਿਸਦਾ ਕਿਸਦਾ ਕਿਵੇਂ ਥੋੜ੍ਹਾ ਪ੍ਰੋਸੀਜਰ ਥੋੜ੍ਹਾ ਦੱਸੋ ਇਸਦਾ ਠੀਕ ਹੈ ਅਤੇ ਸਰ ਉੱਥੇ ਜਾਣ ਤੋਂ ਪਹਿਲਾਂ ਓਨਲਾਈਨ ਕਿਵੇਂ ਅਮਪਲਾਈ ਹੋਵੇਗਾ ਠੀਕ ਹੈ ਸਰ ਅਤੇ ਸੈਂਟਰ ਜਾ ਕੇ ਉੱਥੇ ਸਾਰੇ ਓਰੀਜਨਲ ਡਾਕਯੂਮੈਂਟ ਪੇਸ਼ ਕਰਨੇ ਪੈਣਗੇ ਓਕੇ ਅਤੇ ਸਰ ਅਗਰ ਓਨਲਾਈਨ ਨਹੀਂ ਅਪਲਾਈ ਕਰਨਾ ਤਾਂ ਆਫਲਾਈਨ ਡਾਕ ਦੇ ਥਰੂ ਜਾਂ ਕਿਸੇ ਹੋਰ ਰਾਹੀਂ ਨਹੀਂ ਅਪਲਾਈ ਕਰ ਸਕਦੇ ਠੀਕ ਹੈ ਜੀ ਓਕੇ ਸਰ ਅਤੇ ਡੋਕਯੂਮੈਂਟਸ ਹੋ ਗਏ ਸਰ ਹਾਂਜੀ ਓਕੇ ਥੈਂਕ ਯੂ ਸਰ